ਹੈਲੋ ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਕੀ ਹਾਲ ਜੇ ਓ ਓ ਹਾਂਜੀ ਹਾਂਜੀ ਉਹ ਹਾਂ ਮੈਨੂੰ ਆਈ ਨੂੰ ਤਾਂ ਹੋ ਗਏ ਦੋ ਤਿੰਨ ਦਿਨ ਇੱਥੇ ਤਾਂ ਤੁਹਾਡੇ ਅੰਮ੍ਰਿਤਸਰ ਤਾਂ ਬੜਾ ਬੁਰਾ ਹਾਲ ਜੇ ਟ੍ਰੈਫਿਕ ਦਾ ਹਾਂਜੀ ਹਾਂਜੀ ਹਾਂਜੀ ਆ ਮੈਂ ਤਾਂ ਬੱਸ 'ਤੇ ਆਈ ਹਾਂ ਚੰਡੀਗੜ੍ਹੋਂ ਅਤੇ ਬੱਸ ਅੱਡੇ 'ਤੇ ਤਾਂ ਆਟੋ ਹੀ ਆਟੋ ਉਹ ਤਾਂ ਕਿਸੇ ਨੂੰ ਲੰਘਣ ਨਾ ਦੇਣ ਨਾ ਉਹ ਕੋਈ ਰੂਲ ਆ ਚੰਡੀਗੜ੍ਹ ਸਾਡੇ ਤਾਂ ਐਨ ਡਿਸਿਪਲਨ ਪੂਰਾ ਜੇ ਅਤੇ ਇੱਥੇ ਅੰਮ੍ਰਿਤਸਰ ਇੰਨਾਂ ਟ੍ਰੈਫਿਕ ਆ ਹਾਂਜੀ ਹਾਂਜੀ ਆਟੋ ਵਗੈਰਾ ਵੀ ਬਹੁਤ ਆ ਅਤੇ ਬੱਸਾਂ ਵਾਲੇ ਵੀ ਜਿੱਧਰ ਨੂੰ ਮਰਜ਼ੀ ਮਤਲਬ ਕੋਈ ਹਾਰਨ ਮਾਰੀ ਜਾਂਦੇ ਰੌਲਾ ਹੀ ਰੌਲਾ ਬਹੁਤ ਸ਼ੋਰ ਆ ਹਾਂਜੀ ਹਾਂਜੀ ਬਹੁਤ ਜ਼ਿਆਦਾ ਇੱਥੇ ਪਤਾ ਨਹੀਂ ਪਬਲਿਕ ਜ਼ਿਆਦਾ ਹੋ ਗਈ ਹੈ ਕਿ ਗੱਡੀਆਂ ਜ਼ਿਆਦਾ ਹੋ ਗਈਆਂ ਘਰ ਘਰ ਹਾਂਜੀ ਅੱਛਾ ਜੀ ਅੱਛਾ ਜੀ ਇੱਕ ਘੰਟਾ ਅੰਮ੍ਰਿਤਸਰ 'ਚ ਹੀ ਲੱਗ ਜਾਂਦਾ ਤੁਹਾਨੂੰ ਹੈਂ ਹਾਂ ਓਹੀ ਵੀ ਅੰਮ੍ਰਿਤਸਰ 'ਚ ਹੀ ਘੰਟਾ ਲੱਗ ਜਾਂਦਾ ਤੁਹਾਨੂੰ ਹਾਂ ਬੜਾ ਹਾਂਜੀ ਹਾਂਜੀ ਧੁੰਦਾਂ ਵੀ ਹੈ ਨਾ ਅਤੇ ਇੱਕ ਟੂਰਿਸਟ ਵਗੈਰਾ ਵੀ ਆਉਂਦੇ ਆ ਅਸੀਂ ਗਏ ਦਰਬਾਰ ਸਾਹਿਬ ਵਾਲੀ ਸਾਈਡ 'ਤੇ ਟੂਰਿਸਟ ਗੱਡੀਆਂ ਭੀੜੀਆਂ ਭੀੜੀਆਂ ਉੱਧਰ ਸੜਕਾਂ ਵਾ ਛੋਟੀਆਂ ਛੋਟੀਆਂ ਸੁਲਤਾਨ ਵਿੰਡ ਤੋਂ ਲੈ ਕੇ ਦਰਬਾਰ ਸਾਹਿਬ ਵੱਲ ਜਾਈਏ ਓਹ ਟੂਰਿਸਟ ਗੱਡੀਆਂ ਵਾੜੀ ਜਾਂਦੇ ਆ ਓਹ ਰਿਕਸ਼ੇ ਵੀ ਵਿੱਚੇ ਵਾੜੀ ਜਾਂਦੇ ਈ ਰਿਕਸ਼ਾ ਵੀ ਵਿੱਚੇ ਹੀ ਤੋਂ ਓਹ ਹਾਂ ਉਹ ਰਸਤਾ ਕਿਸੇ ਨੂੰ ਮਿਲਦਾ ਨਹੀਂ

ਹਾਂਜੀ ਹਾਂਜੀ ਹਾਂਜੀ ਇੱਥੇ ਮੈਂ ਇਹ ਵੀ ਵੇਖਿਆ ਵੀ ਟ੍ਰੈਫਿਕ ਵਾਲਾ ਉਹ ਹੈ ਨਹੀਂ ਆ ਕੋਈ ਟ੍ਰੈਫਿਕ ਪੁਲਿਸ ਨਹੀਂ ਨਜ਼ਰ ਆਉਂਦੀ ਨਾ ਕੋਈ ਹੈ ਨਾ ਹਾਂਜੀ

ਹਾਂਜੀ ਹਾਂਜੀ ਠੀਕ ਠੀਕ ਉਹ ਇੱਧਰ ਵੇਖਿਆ ਨਾ ਮੈਂ ਕਿਹਾ ਇੰਨਾਂ ਰੱਸ਼ ਕੋਈ ਰੋਕਦਾ ਹੀ ਨਹੀਂ ਇਹਨਾਂ ਨੂੰ ਦਰਬਾਰ ਸਾਹਿਬ ਵਾਲੇ ਪਾਸੇ ਜਿੱਧਰ ਜਾਂਦੇ ਆ ਉਹ ਤਾਂ ਮੈਂ ਸੁਣਿਆ ਪਲਟ ਪੁਲਟ ਵੀ ਜਾਂਦੇ ਹੌਲੇ ਜਿਹੇ ਹੁੰਦੇ ਆ ਹਾਂਜੀ ਹੈਂਡਲ ਹਾਂਜੀ ਉਹ ਖੇਡ ਖਿਡੌਣੇ ਜਿਹੇ ਹੀ ਆ ਵੈਸੇ ਰਿਸਕੀ ਆ ਟਰੈਵਲ ਕਰਨਾ ਉਹਨਾਂ 'ਚ ਵੀ ਨਾ ਹਮ ਹਾਂਜੀ ਉਸ ਤਰ੍ਹਾਂ ਚਲੋ ਗੁਰੂ ਦੀ ਨਗਰੀ ਪਰ ਟ੍ਰੈਫਿਕ ਦਾ ਤਾਂ ਬਹੁਤ ਹੀ ਜ਼ਿਆਦਾ ਮਾੜਾ ਹਾਲ ਹੋ ਗਿਆ ਭੀੜਾਂ ਹੀ ਭੀੜਾਂ ਆ ਹਲੇ ਕਿ ਫਲਾਈਓਵਰ ਬਣਨ ਨਾਲ ਘੱਟ ਹੋਣੀ ਚਾਹੀਦੀ ਭੀੜ ਸਗੋਂ ਫਲਾਈਓਵਰ ਵੀ ਬਹੁਤ ਜ਼ਿਆਦਾ ਬਣੇ ਹੋਏ ਆ ਮੈਂ ਵੇਖਿਆ ਨਕਸ਼ਾ ਹੀ ਬਦਲਿਆ ਹੋਇਆ ਜੇ ਅੰਮ੍ਰਿਤਸਰ ਦਾ ਫਲਾਈਓਵਰ ਬਣ ਬਣ ਕੇ ਪਰ ਇਹ ਟ੍ਰੈਫਿਕ ਸਗੋਂ ਘਟਣਾ ਚਾਹੀਦਾ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਠੀਕ ਹੈ ਜੀ ਠੀਕ ਓਕੇ ਜੀ ਓਕੇ